ਤੀਹ ਅਗਸਤ ਦੋ ਹਜ਼ਾਰ ਪੰਜ ਦੋ ਦਿਸੰਬਰ ਦੋ ਉੱਨੀ ਸੌ ਇਕਾਸੀ ਪੱਚੀ ਜਨਵਰੀ ਦੋ ਹਜ਼ਾਰ ਸਤਾਰ੍ਹਾਂ ਨੌਂ ਜੂਨ ਦੋ ਹਜ਼ਾਰ ਤੇਈ ਸਤਾਰ੍ਹਾਂ ਮਈ ਦੋ ਹਜ਼ਾਰ ਪੰਦਰ੍ਹਾਂ ਧੰਨਵਾਦ